ਪਿਛਲੇ ਸਮਿਆਂ ਦੇ ਮੁਕਾਬਲੇ ਮਹੱਤਵਪੂਰਨ ਵਿਕਾਸ ਇਹ ਹੈ ਕਿ ਅੱਜ ਕੱਲ੍ਹ ਆਵਾਜਾਈ ਬਹੁਤ ਜ਼ਿਆਦਾ ਵੱਧ ਗਈ ਹੈ ਕਿਉਂਕਿ ਪਹਿਲਾਂ ਦੇ ਲੋਕ ਹਾਂ ਪਿਛਲੇ ਸਮੇਂ ਦੇ ਲੋਕ ਬਸ ਸਟੈਂਡ ਤੱਕ ਤੁਰ ਕੇ ਜਾਂਦੇ ਸਨ ਅੱਜ ਕੱਲ੍ਹ ਦੇ ਸਮੇਂ ਵਿੱਚ ਹਰ ਲੋਕਾਂ ਕੋਲ ਸਕੂਟਰੀਆਂ ਮੋਟਰਸਾਈਕਲ ਕਾਰਾਂ ਗੱਡੀਆਂ ਸਾਰਾ ਕੁਝ ਹੈ ਕਿਉਂ ਕਿਉਂਕਿ ਘਰਾਂ ਦੇ ਬਾਹਰ ਵੀ ਆਟੋ ਹੀ ਲੱਗੇ ਹੋਏ ਹਨ ਅਤੇ ਅਸੀਂ ਸਾਨੂੰ ਜਾਣ ਵਿੱਚ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਕਿਉਂਕਿ ਉਸ ਵਿੱਚ ਹਾਂ ਬਹੁਤ ਹੀ ਸਾਰਾ ਵਿਕਾ ਅੱਜ ਦੇ ਸਮੇਂ ਵਿੱਚ ਬਹੁਤ ਹੀ ਸਾਰਾ ਵਿਕਾਸ ਹੋਇਆ ਹੈ ਸਿੱਖ ਕ ਸਿੱਖ ਇਤਿਹਾ ਸਿੱਖ ਘਟਨਾ ਵਿੱਚ ਹਾਂ ਸਿੱਖਾਂ ਨੇ ਸਿੱਖਾਂ ਸਿੱਖਾਂ ਦੇ ਭਾਈ ਸਿੱਖ ਬਹੁਤ ਸਾਰੇ ਭਾਈਚਾਰਿਆਂ ਨਾਲ ਮਿਲ ਚੁੱਕੇ ਹਨ ਅਤੇ ਉਹ ਹਾਂ ਲੜਨ ਲਈ ਡਰਦੇ ਨਹੀਂ ਸਾਨੂੰ ਉਹ ਬਰਾਬਰੀ ਦਾ ਸਾਹਮਣਾ ਕਰਦੇ ਹਨ ਕਿਉਂਕਿ ਕਿਉਂਕਿ ਸਿੱਖ ਇਤਿਹਾਸ ਹਾਂ ਅੱਜ ਕੱਲ੍ਹ ਇਕੱਠਾ ਹੋ ਚੁੱਕਿਆ ਹੈ ਭਾਈਚਾਰੇ ਸਾਰੇ ਇਕੱਠੇ ਹੋ ਗਏ ਹਨ ਕਿਉਂਕਿ ਉਹ ਹੁਣ ਉਹਨਾਂ ਨੂੰ ਕੋਈ ਵੀ ਡਰਾਵੇ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹ ਸਾਰੇ ਇੱਕ ਦੂਜੇ ਨਾਲ ਮਿਲ ਚੁੱਕੇ ਹਨ